ਨਮਸਤੇ ਜੀ ਸਤਿ ਸ਼੍ਰੀ ਅਕਾਲ ਨਾਲੇ ਜੀ ਅਸੀਂ ਫੁੱਲ ਫੁੱਲ ਲੈਣੇ ਚਾਹੁੰਦੇ ਤੁਹਾਡੇ ਕੋਲੋਂ ਕਿਹੜੇ ਕਿਹੜੇ ਫੁੱਲ ਹੈ ਤੁਹਾਡੇ ਕੋਲ

ਅਸੀਂ ਘਰ ਵਿੱਚ ਲਾਉਣੇ ਹੈ ਕੋਕੋਕੋਲੇ ਵੀ ਮਿਲ ਜਾਣਗੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਗੱਡੀ ਤੁਹਾਨੂੰ ਦਿਖਾ ਦਿਆਂਗੇ

ਠੀਕ ਹੈ ਜੀ ਠੀਕ ਹੈ